ਸਾਡੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਪਹਿਲਾਂ ਤਾਂ ਸਕੂਲ ਦੀ ਹਾਲਤ ਵਧੀਆ ਸੀ ਪਰ ਹੁਣ ਨਾ ਤਾਂ ਹਾਲਤ ਹੀ ਵਧੀਆ ਹੈ ਅਤੇ ਨਾ ਹੀ ਅਧਿਆਪਕ ਪੂਰੇ ਹਨ ਸਕੂਲ ਦੀ ਇਮਾਰਤ ਵਿੱਚ ਖਸਤਾ ਹੋ ਗਈ ਹੈ ਜਿਸ ਵੱਲ ਸਰਕਾਰ ਦਾ ਧਿਆਨ ਨਹੀਂ ਹੈ ਸਕੂਲ ਵਿੱਚ ਕਿਤਾਬਾਂ ਤਾਂ ਮਿਲਣਾ ਦੂਰ ਸਕੂਲ ਪੀਣ ਵਾਲੇ ਪਾਣੀ ਦਾ ਵੀ ਨਹੀਂ ਸਹੀ ਪ੍ਰਬੰਧ ਹੈ ਜਵਾਕ ਸਕੂਲ ਵਿੱਚ ਬਾਹਰ ਆ ਕੇ ਨਾਲ ਦੇ ਨਾਲ ਦੇ ਗੁਰਦੁਆਰਾ ਸਾਹਿਬ ਵਿੱਚ ਪਾਣੀ ਭਰ ਕੇ ਲੈ ਕੇ ਜਾਂਦੇ ਹਨ ਸਕੂਲ ਵਿੱਚ ਭੋਜਨ ਦੀ ਭੋਜਨ ਵੀ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਬਾਰੇ ਅਜੇ ਚੰਗਾ ਚੰਗੀ ਤਰ੍ਹਾਂ ਪਤਾ ਨਹੀਂ ਕਿ ਕਿੱਦਾਂ ਦਾ ਬਣਾਇਆ ਜਾਂਦਾ ਹੈ ਬਾਕੀ ਸਰਕਾਰਾਂ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਪਿੰਡ ਦੀ ਪੰਚਾਇਤ ਵੀ ਸਕੂਲ ਵੱਲ ਧਿਆਨ ਦੇ ਰਹੀ ਹੈ ਪੀਣ ਵਾਲੇ ਪਾਣੀ ਲਈ ਇੱਕ ਵਾਟਰ ਕੂਲਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਪੰਜ ਕਲਾਸਰੂਮ ਨਵੇਂ ਬਣਾਏ ਗਏ ਹਨ ਅਤੇ ਅੱਗੇ ਵੀ ਪੰਚਾਇਤ ਅਤੇ ਪਿੰਡ ਦੇ ਲੋਕ ਸਕੂਲ ਵਿੱਚ ਸੁਧਾਰ ਕਰਦੇ ਰਹਿਣਗੇ